ਬਾਈਕਿੰਗ ਦੁਆਰਾ ਸਮਾਜਿਕ ਸਮਾਨਤਾ ਨੂੰ ਕਿਵੇਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਬਾਈਕਿੰਗ ਇੱਕ ਚੰਗੀ ਭਾਵਨਾ ਅਤੇ ਸੰਕੇਤ ਦਿੰਦਾ ਹੈ ਬਾਈਕਿੰਗ ਦੁਆਰਾ ਸਮਾਜਿਕ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਸਾਰਿਆਂ ਨੂੰ ਪਹੁੰਚਣਯੋਗ ਬਣਾਉਣਾ ਬਾਈਕਿੰਗ ਨੂੰ ਸਾਰੇ ਲੋਕਾਂ ਲਈ ਪਹੁੰਚਣਯੋਗ ਬਣਾਉਣਾ ਚਾਹੇ ਉਹਨਾਂ ਨੂੰ ਆਰਥਿਕ ਸਥਿਤੀ ਲਿੰਗ ਜਾਂ ਸਰੀਰਿਕ ਯੋਗਤਾ ਹੋਵੇ ਇਸ ਵਿੱਚ ਸਸਤੀਆਂ ਬਾਈਕਾਂ ਸੁਰੱਖਿਅਤ ਬਾਈਕਾਂ ਮਾਰਗਾਂ ਅਤੇ ਅਪਾਹਿਜ ਬਾਈਕਾਂ ਲਈ ਅਨਕੂਲ ਸਹੂਲਤਾਂ ਸ਼ਾਮਿਲ ਹਨ ਵੱਖ ਵੱਖ ਪਿਛੋਕੜਾਂ ਅਤੇ ਸਮੂਹਾਂ ਦੇ ਲੋਕਾਂ ਨੂੰ ਸ਼ਾਮਿਲ ਕਰਨ ਵਾਲੇ ਬਾਈਕਿੰਗ ਸਮੂਹਾਂ ਨੂੰ ਉਤਸ਼ਾਹਿਤ ਕਰਨਾ ਇਹ ਸਮਾਜਿਕ ਸਮਾਨਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਵੱਖ ਵੱਖ ਸੱਭਿਆਚਾਰਾਂ ਵਿਚਾਰਕ ਸਮਝ ਨੂੰ ਵਧਾਉਂਦਾ ਹੈ ਬਾਈਕਿੰਗ ਸੁਰੱਖਿਆ ਬਾਰੇ ਸਿੱਖਿਆ ਪ੍ਰਦਾਨ ਕਰਨਾ ਤਾਂ ਸ ਸਾਰੇ ਬਾਈਕ ਸੜਕਾਂ 'ਤੇ ਸੁਰੱਖਿਅਤ ਰਹਿ ਸਕਣ ਦੂਜੇ ਬਾਇਕਰਾਂ ਅਤੇ ਡਰਾਈਵਰਾਂ ਨਾਲ ਸੰਚਾਰ ਕਰਨ ਲਈ ਹੱਥ ਦੇ ਸੰਕੇਤਾਂ ਦੀ ਵਰਤੋਂ ਕਰਨਾ ਸਾਰੇ ਟਰੈਫਿਕ ਨਿਯਮਾਂ ਅਤੇ ਨਿਯਮਾਂ ਦੀ ਪਾਲਣਾ ਕਰਕੇ ਸੁਰੱਖਿਅਤ ਢੰਗ ਨਾਲ ਸਵਾਰੀ ਕਰਨਾ ਸੜਕ ਦੇ ਬਾਇਕਰਾਂ ਨਾਲ ਸ ਸਤਿਕਾਰ ਸਤਿਕਾਰ ਕਰਨਾ ਅਤੇ ਉਹਨਾਂ ਨਾਲ ਸਹਿਯੋਗ ਕਰਨਾ ਹੈਲਮੈਟ ਪਹਿਨਣਾ ਅਤੇ ਹੈਲਮੈਟ ਪਹਿਨਾਉਣਾ ਹਮੇਸ਼ਾ ਹੈਲਮੈਟ ਪਾ ਕੇ ਰੱਖਣਾ ਮੁਸਕਰਾਉਣਾ ਅਤੇ ਨਮਸਕਾਰ ਕਰਨਾ ਦੂਜੇ ਬਾਇਕਰਾਂ ਅਤੇ ਰਾਹਗੀਰਾਂ ਨੂੰ ਮੁਸਕਰਾਉਣਾ ਅਤੇ ਨਮਸਕਾਰ ਕਰਨਾ ਹਮੇਸ਼ਾ ਖੱਬੇ ਹੱਥ ਹੀ ਚੱਲਣਾ ਅਤੇ ਸੜਕ ਨਿਯਮਾਂ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਅਤੇ ਹਮੇਸ਼ਾ ਬਾਇਕਾਂ ਬਾਈਕ ਨੂੰ ਸਾਰੇ ਲੋਕਾਂ ਤੱਕ ਪਹੁੰਚਾਉਣਾ ਚਾਹੇ ਉਹਨਾਂ ਨੂੰ ਆਰਥਿਕ ਸਥਿਤੀ ਦੀ ਜ਼ਰੂਰਤ ਹੋਵੇ ਜਾਂ ਨਹੀਂ